ਪੰਜਾਬ ਵਿੱਚ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਨੂੰ ਅੱਜ ਤੱਕ ਅਸੀਂ ਪੜ੍ਹਦੇ ਆਏ ਹਾਂ ਸੁਣਦੇ ਆਏ ਹਾਂ ਅਤੇ ਹੁਣ ਵੀ ਅਸੀਂ ਪੜ੍ਹ ਰਹੇ ਹਾਂ ਜਿਵੇਂ ਕਿ ਸੰਨ ਉੱਨੀ ਸੌ ਚੁਰਾਸੀ ਵਿੱਚ ਜਿਹੜਾ ਬਹੁਤ ਸਾਰੇ ਦੰਗੇ ਹੋਏ ਸੀਗੇ ਜਿਹਨਾਂ ਵਿੱਚੋਂ ਇੱਕ ਜਨਰਲ ਡਾਇਰ ਸੀਗਾ ਜਿਹਨੇ ਅਨੇਕਾਂ ਹੀ ਲੋਕਾਂ ਨੂੰ ਕੀ ਕਹਿੰਦੇ ਆ ਮਾਰ ਦਿੱਤਾ ਸੀਗਾ ਜਿਹਨਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਉਹਨਾਂ ਨੂੰ ਮਾਰ ਦਿੱਤਾ ਸੀ ਅਤੇ ਉਹ ਸ਼ਹੀਦ ਹੋ ਚੁੱਕੇ ਸੀਗੇ ਆਪ ਆਪਣੇ ਦੇਸ਼ ਲਈ ਅਤੇ ਫਿਰ ਉਹਨਾਂ ਨੇ ਅੰਮ੍ਰਿਤਸਰ ਉੱਤੇ ਹਮਲਾ ਕੀਤਾ ਹਰਿਮੰਦਰ ਸਾਹਿਬ ਉੱਤੇ ਵੀ ਹਮਲਾ ਕੀਤਾ ਸੀਗਾ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀਗਾ ਅਤੇ ਪੰਜ ਸਾਹਿਬ ਸਾਹਿਬਜ਼ਾਦਿਆਂ ਨਾਲ ਵੀ ਇਹ ਹੀ ਘਟਨਾਵਾਂ ਕੁਛ ਵਾਪਰੀਆਂ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਆਪਣਾ ਸਿੱਖ ਧਰਮ ਛੱਡ ਕੇ ਮੁਸਲਿਮ ਧਰਮ ਨੂੰ ਅਪਣਾ ਲੈਣ ਮੁਗ਼ਲਾਂ ਨੇ ਵੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਸੀਗੇ ਸਿੱਖਾਂ ਉਤੇ ਪਰ ਜਿਹੜੇ ਸਾਹਿਬਜ਼ਾਦੇ ਸੀਗੇ ਉਹ ਬਹੁਤ ਹੀ ਜ਼ਿਆਦਾ ਨਿਡਰ ਬਣ ਕੇ ਆਪਣੇ ਮਤਲਬ ਡੱਟ ਕਿ ਖੜ੍ਹੇ ਰਹੇ ਪੂਰੇ ਤਾਕਤ ਨਾਲ ਕਿ ਉਹ ਆਪਣਾ ਧਰਮ ਨਹੀਂ ਛੱਡਣਗੇ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਅ ਉਹਨਾਂ ਨੇ ਜ਼ੁਰਮ ਕੀਤੇ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਆਖਰਕਾਰ ਉਹਨਾਂ ਨੂੰ ਇੱਟਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਜਿ ਜਿਹਦੇ ਕਰਕੇ ਅਰ ਉਹ ਉੱਥੇ ਹੀ ਸ਼ਹੀਦ ਹੋ ਗਏ ਸੀ ਪਰ ਉੱਥੇ ਵੀ ਉਹ ਮਤਲਬ ਇੰਨੇ ਜਾਂਬਾਜ ਸੀ ਜਾਂਬਾਜ ਸੀਗੇ ਕਿ ਉਹਨਾਂ ਨੇ ਆਪਣਾ ਧਰਮ ਬਿਲਕੁਲ ਵੀ ਨਹੀਂ ਛੱਡਿਆ ਸੀਗਾ ਐਵੇਂ ਕਰਕੇ ਹੋਰ ਵੀ ਕਾਫੀ ਘਟਨਾਵਾਂ ਸਾਡੇ ਪੰਜਾਬ ਵਿੱਚ ਵਾਪਰੀਆਂ ਹਨ ਜਿਹੜੇ ਬਹੁਤ ਹੀ ਮੁਗ਼ਲ ਹੁੰਦੇ ਸੀ ਉਹਨਾਂ ਨੇ ਕਾਫੀ ਔਰਤਾਂ ਨੂੰ ਵੀ ਜ਼ੁਲਮ ਕੀਤਾ ਸੀਗਾ ਉਹਨਾਂ ਨੂੰ ਕੀ ਕਹਿੰਦੇ ਆ ਨੰਗੇ ਕਰਕੇ ਪੂਰੇ ਬਾਜ਼ਾਰ ਦੇ ਵਿੱਚ ਐਵੇਂ ਛੱਡ ਦਿੱਤਾ ਗਿਆ ਸੀਗਾ ਉਹਨਾਂ 'ਤੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਉੱਥੇ ਹੀ ਮਾਰ ਦਿੱਤਾ ਗਿਆ ਸੀਗਾ ਜੋ ਕਿ ਬਹੁਤ ਹੀ ਗ਼ਲਤ ਚੀਜ਼ ਸੀਗੀ